ਸਤਿ ਸ਼੍ਰੀ ਅਕਾਲ ਜੀ ਸਾਡੇ ਅਨੁਸਾਰ ਉਹ ਮਹਾਨ ਆਗੂ ਜਿਹਨਾਂ ਦੇ ਬਾਰੇ ਸਾਡੇ ਦਾਦੇ ਪੜਦਾਦੇ ਨੇ ਸਾਨੂੰ ਸੁਣਾਇਆ ਸੀ ਉਹ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਅਜਿਹੇ ਆਗੂ ਸਨ ਜਿਹਨਾਂ ਨੇ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸਿੱਖ ਧਰਮ ਦੇ ਜਿਹੜੇ ਸਿਧਾਂਤ ਸੀ ਉਹਨਾਂ ਨੇ ਉਹਨਾਂ ਸਿਧਾਂਤਾਂ 'ਤੇ ਰਹਿ ਕੇ ਆਪਣੇ ਜੀਵਨ ਦਾ ਜਿਹੜਾ ਨਿਰਬਾਹ ਕੀਤਾ ਦੇਸ਼ ਦੀ ਕੌਮ ਦੀ ਖਾਤਰ ਆਪਣਾ ਸਰਬੰਸ ਜਿਹੜਾ ਵਾ ਉਹਨਾਂ ਨੇ ਜਿਹੜਾ ਵਾ ਵਾਰ ਦਿੱਤਾ ਅਤੇ ਜੁਲਮ ਦੇ ਅੱਗੇ ਸਿਰ ਨਹੀਂ ਚੁਕਾਇਆ ਸਾਡੇ ਦਾਦਾ ਜੀ ਦੱਸਦੇ ਸੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੁੰਦੇ ਆ ਕਿ ਜ਼ੁਲਮ ਕਰਨਾ ਵੀ ਪਾਪ ਅਤੇ ਜ਼ੁਲਮ ਸਹਿਣਾ ਵੀ ਪਾਪ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਈ ਸੀ ਜਿਹਦਾ ਕਰਕੇ ਉਹਨਾਂ ਨੂੰ ਮੁਗਲ ਸਮਰਾਜ ਦੇ ਜਿਹੜਾ ਵਾ ਉਹ ਨਾਰਾਜ਼ਗੀ ਜਿਹੜੀ ਆ ਉਹ ਸਹਿਣੀ ਪਈ ਔਰੰਗਜ਼ੇਬ ਨੇ ਕਈ ਤਰ੍ਹਾਂ ਦੇ ਤਸੀਹੇ ਜਿਹੜੇ ਆ ਉਹਨਾਂ ਦੇ ਪਰਿਵਾਰ ਨੂੰ ਵੀ ਦਿੱਤੇ ਅਤੇ ਉਹਨਾਂ ਦੇ ਸ਼ਰਧਾਲੂਆਂ ਨੂੰ ਵੀ ਦਿੱਤੇ ਜਿਹੜੇ ਸਿੱਖ ਰਾਜ ਧਰਮ ਨੂੰ ਜਿਹਨਾਂ ਨੇ ਅਪਣਾਇਆ ਹੋਇਆ ਸੀ ਜਿਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਦਾ ਜਿਹੜਾ ਪ੍ਰਣ ਲਿਆ ਹੋਇਆ ਸੀ ਠੀਕ ਹੈ ਜੀ ਅਤੇ ਉਹ ਦੱਸਦੇ ਸੀ ਕਿ ਸੋਲ੍ਹਾਂ ਸੌ ਨੜਿਨਵੇਂ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਖਾਲਸੇ ਨੂੰ ਹੋਲਾ ਮਹੱਲਾ ਮਨਾਉਣ ਲਈ ਜਿਹੜਾ ਸੀ ਉਹ ਕਿਹਾ ਅਤੇ ਅੱਜ ਵੀ ਉਸ ਸਥਾਨ 'ਤੇ ਜਿਹੜਾ ਵਾ ਉਹ ਧੂਮ ਧਾਮ ਨਾਲ ਹਰ ਸਾਲ ਜਿਹੜਾ ਵਾ ਉਹ ਮੇਲਾ ਮਨਾਇਆ ਜਾਂਦਾ ਅਤੇ ਵੇਖਿਆ ਜਾਵੇ ਤਾਂ ਇਹਨਾਂ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਮਹਾਨ ਸ਼ਖਸ਼ੀਅਤ ਆ ਉਹਨਾਂ ਨੇ ਸਾਡੇ ਪੰਜਾਬ ਵਿੱਚ ਪੰਜਾਬ ਦੀ ਇਤਿਹਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਲੋਕਾਂ ਨੂੰ ਜਿਹੜੀਆਂ ਵਾ ਉਹ ਨਾਮ ਜਪਣ ਵੰਡ ਛਕਣ ਕਿਰਤ ਕਰਨ ਅਤੇ ਡਟ ਕੇ ਆਪਣਾ ਹੱਕ ਸੱਚ ਲਈ ਜੀਵਨ ਜੀਣ ਦੀ ਜਿਹੜੀ ਆ ਉਹ ਪ੍ਰੇਰਨਾ ਦਿੱਤੀ ਹੈ ਇਸ ਲਈ ਉਹਨਾਂ ਨੇ ਸਾਡੇ ਖੇਤਰ ਦੇ ਇਤਿਹਾਸ ਵਿੱਚ ਆਪਣਾ ਮਹੱਤਵਪੂਰਨ ਸਥਾਨ ਸਥਾਪਿਤ ਕੀਤਾ ਵਾ ਅਸੀਂ ਹੀ ਸਾਰੇ ਦੇਸ਼ ਵਿਦੇਸ਼ ਪੂਰੀ ਦੁਨੀਆਂ ਦੇ ਵਿੱਚ ਉਹਨਾਂ ਨੂੰ ਇੱਕ ਗੁਰੂ ਦੇ ਤੌਰ 'ਤੇ ਪੂਜਿਆ ਜਾਂਦਾ ਵਾ ਅਸੀਂ ਆਪਣੀਆਂ ਦੁਖੀਆਂ ਤਕਲੀਫਾਂ ਦੀ ਤਕਲੀਫਾਂ ਦੀ ਦਾਹ ਤੋਂ ਛੁਟਕਾਰਾ ਪਾਉਣ ਦੀ ਅਰਦਾਸ ਸਾਹਸ ਬਲ ਦੀ ਅਰਦਾਸ ਗੁਰੂ ਗੋਬਿੰਦ ਸਿੰਘ ਜੀ ਅੱਗੇ ਕਰਦੇ ਠੀਕ ਹੈ ਜੀ ਇਸ ਲਈ ਇਹਨਾਂ ਵਰਗਾ ਨਾ ਕੋਈ ਮਹਾਨ ਆਗੂ ਯੋਧਾ ਦੁਨੀਆਂ 'ਤੇ ਹੋਇਆ ਅਤੇ ਨਾ ਹੀ ਕੋਈ ਹੋਣਾ ਜਿਹਨਾਂ ਨੇ ਸਿੱਖ ਕੌਮ ਲਈ ਦੇਸ਼ ਦੀ ਕੌਮ ਲਈ ਆਮ ਲੋਕਾਂ ਲਈ ਆਪਣਾ ਪਰਿਵਾਰ ਆਪਣਾ ਸਰਬੰਸ ਤੱਕ ਜਿਹੜਾ ਵਾ ਉਹ ਵਾਰ ਦਿੱਤਾ ਠੀਕ ਹੈ ਧੰਨਵਾਦ